ਮੈਂ ਚਿੱਤਰਕਾਰੀ ਲਈ ਕੁਦਰਤ ਵੱਖ ਵੱਖ ਰੰਗਾਂ ਅਤੇ ਆਪਣੀਆਂ ਭਾਵਨਾਵਾਂ ਨੂੰ ਦਰਸਾਉਣ ਦੀ ਇੱਛਾ ਤੋਂ ਪ੍ਰੇਰਿਤ ਹੋਈ ਬਚਪਨ ਤੋਂ ਹੀ ਮੈਨੂੰ ਰੰਗਾਂ ਨਾਲ ਖੇਡਣਾ ਅਤੇ ਚਿੱਤਰ ਬਣਾਉਣ ਦਾ ਸ਼ੌਂਕ ਸੀ ਹਰ ਚੀਜ਼ ਨੂੰ ਆਪਣੇ ਤਰੀਕੇ ਨਾਲ ਦਰਸਾਉਣ ਦੀ ਕੋਸ਼ਿਸ਼ ਕਰਦੀ ਰਹੀ ਸ਼ੁਰੂ ਵਿੱਚ ਮੈਂ ਸਿਰਫ ਆਮ ਡਰੋਇੰਗ ਅਤੇ ਰੰਗ ਭਰਨਾ ਕਰਦੀ ਸੀ ਪਰ ਹੌਲੀ ਹੌਲੀ ਨਵੇਂ ਤਰੀਕਿਆਂ ਬਾਰੇ ਜਾਣਨਾ ਸ਼ੁਰੂ ਕੀਤਾ ਸਮੇਂ ਦੇ ਨਾਲ ਮੈਂ ਸ਼ੈਡੋ ਡਿਟੇਲਿੰਗ ਅਤੇ ਹੋਰ ਤਰੀਕੇ ਅਜ਼ਉਮਾਣ ਲੱਗੀ ਇੰਟਰਨੈਟ ਅਤੇ ਹੋਰ ਕਲਾਕਾਰਾਂ ਦੇ ਕੰਮ ਅਤੇ ਆਪਣੇ ਅਭਿਆਸ ਨੇ ਮੈਨੂੰ ਇਸ ਵਿੱਚ ਮਾਹਿਰ ਕਰ ਦਿੱਤਾ ਹੁਣ ਚਿੱਤਰਕਾਰੀ ਮੇਰੇ ਲਈ ਸਿਰਫ ਇੱਕ ਸ਼ੌਂਕ ਨਹੀਂ ਸਗੋਂ ਮੇਰੀ ਭਾਵਨਾਵਾਂ ਨੂੰ ਦਰਸਾਉਣ ਦਾ ਇੱਕ ਤਰੀਕਾ ਬਣ ਗਿਆ ਹੈ ਧੰਨਵਾਦ